ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਵਿੱਚ ਸਾਫ ਸਫਾਈ ਰੱਖੋ ਘਰ ਦੇ ਆਲੇ ਦੁਆਲੇ ਇਲਾਕੇ ਨੂੰ ਸਾਫ ਰੱਖੋ ਤਾਂ ਜੋ ਡੇਂਗੂ ਅਤੇ ਮਲੇਰੀਆ ਦੇ ਮੱਛਰ ਹਨ ਉਹ ਨਾ ਆ ਪਾਉਣ ਅਤੇ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਓ ਕਿਉਂਕਿ ਪਾਣੀ ਜਮ੍ਹਾਂ ਹੋਣ ਦੇ ਨਾਲ ਲਾਰਬਾ ਆਉਂਦਾ ਹੈ ਜਿਸ ਨਾਲ ਮੱਛਰ ਪੈਦਾ ਹੁੰਦੇ ਹਨ ਅਤੇ ਉਹ ਫਿਰ ਐਸੀਆਂ ਬਿਮਾਰੀਆਂ ਫੈਲਾਉਂਦੇ ਹਨ ਸੌਖੀ ਥਾਵਾਂ ਤੋਂ ਪਾਣੀ ਖਤਮ ਕਰੋ ਪਾਣੀ ਦੀ ਟੈਂਕੀ ਗਮਲੇ ਅਤੇ ਹੋਰ ਥਾਵਾਂ ਵਿੱਚ ਜਿੱਥੇ ਪਾਣੀ ਪੈਦਾ ਹੋ ਸਕਦਾ ਹੈ ਉਹਨਾਂ ਨੂੰ ਸਾਫ ਰੱਖੋ ਉਹਨਾਂ ਵਿੱਚ ਪਾਣੀ ਨੂੰ ਨਾ ਖੁੱਲ੍ਹਣ ਦਿਓ ਅਤੇ ਮੱਛਰਦਾਨੀ ਦੀ ਵਰਤੋਂ ਕਰੋ ਜਦੋਂ ਸੋਵੋ ਮੱਛਰਦਾਨੀ ਲਗਾ ਲਓ ਅਤੇ ਬਹੁਤ ਸਾਰੇ ਅੱਜ ਕੱਲ੍ਹ ਮੱਛਰ ਮਾਰਨ ਵਾਲੀ ਇੱਕ ਯੰਤਰ ਵੀ ਆਉਂਦੇ ਹਨ ਜਿਵੇਂ ਗੁਡ ਨਾਈਟ ਕੰਪਨੀ ਦੇ ਆਉਂਦੇ ਹਨ ਅਤੇ ਹੋਰ ਆਦਿ ਕੰਪਨੀਆਂ ਦੇ ਆਉਂਦੇ ਹਨ ਉਹਨਾਂ ਦਾ ਇਸਤੇਮਾਲ ਕਰੋ ਆਪਣੇ ਸਰੀਰ ਨੂੰ ਢੱਕ ਕੇ ਰੱਖੋ ਆਪਣੇ ਬੱਚਿਆਂ ਦੇ ਸਰੀਰ ਨੂੰ ਢੱਕ ਕੇ ਰੱਖੋ ਜਿਸ ਨਾਲ ਮੱਛਰ ਤੁਹਾਡੇ ਉੱਪਰ ਹਮਲਾ ਨਾ ਕਰ ਪਾਉਣ ਅਤੇ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਓਡੋਮੋਂਸ ਲਗਾਓ ਕਈ ਲੋਕ ਨਾਰੀਅਲ ਦਾ ਤੇਲ ਲਗਾਉਂਦੇ ਹੁੰਦੇ ਹਨ ਮੱਛਰਾਂ ਤੋਂ ਬਚਣ ਲਈ ਅਤੇ ਆਪਣੇ ਘਰ ਵਿੱਚ ਖਿਆਲ ਰੱਖੋ ਕਿ ਕੋਈ ਵੀ ਕੂਲਰ ਦੇ ਅੰਦਰ ਪਾਣੀ ਨਾ ਜ਼ਿਆਦਾ ਦੇਰ ਤੱਕ ਜਮ੍ਹਾਂ ਰਹੇ ਅਤੇ ਬਾਰਿਸ਼ ਦੇ ਦਿਨਾਂ ਵਿੱਚ ਗਮਲਿਆਂ 'ਚ ਪਾਣੀ ਨਾ ਜਮ੍ਹਾਂ ਹੋਏ ਤੁਹਾਡੀ ਛੱਤ 'ਤੇ ਪਾਣੀ ਨਾ ਜਮ੍ਹਾਂ ਹੋਏ ਗਲੀ ਚ ਨਾ ਪਾਣੀ ਜਮ੍ਹਾਂ ਹੋਏ ਅਤੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪਾਥੀਆਂ ਦਾ ਧੂੰਆਂ ਵੀ ਆਪਣੇ ਘਰ ਵਿੱਚ ਕਰ ਸਕਦੇ ਹੋ ਜਿਸ ਨਾਲ ਮੱਛਰ ਖਤਮ ਹੋ ਜਾਂਦੇ ਹਨ ਤੁਸੀਂ ਇਹਨਾਂ ਕੁਝ ਤਰੀਕਿਆਂ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬੁਖਾਰ ਤੋਂ ਬਚ ਸਕਦੇ ਹੋ